ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਵੀਗੀ ਤੋਂ ਗੱਲ ਕਰ ਰਹੇ ਹੋ ਜੀ ਹਾਂਜੀ ਮੈਂ ਨਾ ਔਡਰ ਕੀਤਾ ਸੀਗਾ ਜੀ ਆਪਣੇ ਚ ਚਾਰ ਪੀਜੇ ਔਡਰ ਕੀਤੇ ਸੀਗੇ ਜੀ ਦੋ ਵੈਜ ਸੀ ਦੋ ਨੋਨ ਵੈਜ ਸੀ ਹਾਂਜੀ ਦੋ ਪਨੀਰ ਵਾਲੇ ਸੀ ਦੋ ਕੈਪਸ਼ੀਅਨ ਸੀਗੇ ਹਾਂਜੀ ਅਤੇ ਨਾਲ ਹੀ ਚਾਰ ਬਰਗਰ ਸੀ ਹਾਂਜੀ ਚਾਰ ਬਰਗਰ ਅਤੇ ਉਹ ਨਾ ਮੈਂ ਆਪਣੇ ਲੀਕਿਊਡ ਚੀਜ਼ਾਂ ਭੁੱਲ ਗਿਆ ਸੀ ਪੀਣ ਲਈ ਉਹ ਮਤਲਬ ਤਿੰਨ ਕੋਲਡ ਡਰਿੰਕ ਕਰ ਦਿਉ ਜੀ ਪੰਜ ਗਿਲਾਸ ਕਰ ਦਿਉ ਜੀ ਹਾਂਜੀ ਅਤੇ ਕੁਛ ਮਿੱਠਾ ਕਰ ਦਿਉ ਨਾਲ ਜਿਵੇਂ ਰਸਗੁੱਲਾ ਵਗੈਰਾ ਜੀ ਵੀਹ ਕੁ ਪੀਸ ਉਸਦੇ ਕਰ ਦਿਉ ਜੀ ਹਾਂਜੀ